ਮੇਰਾ ਨਾਮ ਭਾਰਤ ਭੂਸ਼ਣ ਪਿੰਡ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਪੰਜਾਬੀ ਭਾਸ਼ਾ ਵਿੱਚ ਕੁਝ ਦਿਲਚਸਪ ਅਤੇ ਅਸਾਧਾਰਨ ਸ਼ਬਦ ਦਾ ਵਾਕ ਇਸ ਤਰ੍ਹਾਂ ਹਨ ਈਹਾਂ ਸਰਦਾਰਨੀ ਇਹ ਵਰਤਣ ਵਿੱਚ ਕੁਝ ਖ਼ਾਸ ਤੌਰ 'ਤੇ ਪੰਜਾਬੀ ਮਹਿਲਾਵਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਇਹ ਇਹ ਨੇਕ ਸਰਦਾਰ ਦੀ ਪਤਨੀ ਨੂੰ ਸੰਦੋ ਸੰਬੋਧਿਤ ਕਰਨ ਲਈ ਵਰਤਿਆ ਜਾਂਦਾ ਹੈ ਦੂਜਾ ਸ਼ਬਦ ਇਹੋ ਜਿਹਾ ਆ ਪੁਟ ਫੁੱਟਪਾਥ ਇਹ ਸ਼ਬਦ ਪੰਜਾਬੀ ਵਿੱਚ ਵਰਤਿਆ ਹਰੇਕ ਦੀ ਚ ਚੱਲਣ ਵਿੱਚ ਹੁੰਦੀ ਹੈ ਇਹਨੂੰ ਇਹਦਾ ਮਤਲਬ ਹੈ ਕਿ ਦਿਲਚਸਪ ਜਾਂ ਅਸਧਾਰਨ ਮਾਰਗ ਜਾਂ ਰਾਹ 'ਤੇ ਚੱਲਣ ਵਾਲਾ ਵਿਅਕਤੀ ਤੀਸਰਾ ਸ਼ਬਦ ਬਚਪਨ ਦੀਵਾਰ ਹੈ ਇਹ ਸ਼ਬਦ ਬਚਪਨ ਦੀਆਂ ਯਾਦਾਂ ਅਤੇ ਬਚਪਨ ਦੀਆਂ ਗੱਲਾਂ ਲਈ ਵਰਤਿਆ ਜਾਂਦਾ ਹੈ ਇਹਦਾ ਮਤਲਬ ਬਚਪਨ ਦੀਆਂ ਯਾਦਾਂ ਨੂੰ ਲੈ ਕੇ ਕੋਈ ਵੀ ਗੱਲ ਕਰਨਾ ਹੁੰਦਾ ਹੈ ਚੌਥਾ ਸ਼ਬਦ ਹੈ ਬਹੁ ਬਹੁ ਸਕ ਇਹ ਸ਼ਬਦ ਬੋਲਣ ਦੁਆਰਾ ਵਰਤਿਆ ਜਾਂਦਾ ਹੈ ਜਦੋਂ ਕਿਸੇ ਦੀ ਕਿਸੇ ਨਾਲ ਸ਼ਾਨਦਾਰ ਤੋਂ ਸ਼ਾਨਦਾਰ ਸਮਝਿਆ ਜਾਵੇ ਤਾਂ ਉਹ ਵਿਅਕਤੀ ਨੂੰ ਮਹ ਬਹੁ ਸਕ ਮੰਨਿਆ ਜਾਂਦਾ ਹੈ ਛ ਪੰਜਵਾਂ ਸ਼ਬਦ ਹੈਗਾ ਛਾਪਿਆ ਇਹ ਸ਼ਬਦ ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਜਿਹੜੇ ਬਹੁਤ ਦੂਰੀਆਂ ਤੱਕ ਪਹੁੰਚ ਗਈ ਹੋਵੇ ਉਦਾਹਰਨ ਦੇ ਤੌਰ 'ਤੇ ਉਹ ਅੱਜ ਤੱਕ ਬੱਲੇ ਨਾਲ ਛਾਪਿਆ ਗਿਆ ਹੈ ਧੰਨਵਾਦ ਜੀ